ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਸਿੰਘ ਆਪ ਜੀ ਦੀ ਗਿੱਲ ਟਰਾਂਸਪੋਰਟ ਏਜੰਸੀ ਦਾ ਰੈਗੂਲਰ ਗ੍ਰਾਹਕ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਇਸ ਲਈ ਮੈਂ ਆਪਣੇ ਪਰਿਵਾਰ ਸਮੇਤ ਕਿਸੇ ਹਿੱਲ ਸਟੇਸ਼ਨ 'ਤੇ ਘੁੰਮਣ ਜਾਣਾ ਚਾਹੁੰਦਾ ਹਾਂ ਜਿਵੇਂ ਕਿ ਕੁੱਲੂ ਮਨਾਲੀ ਲੇਹ ਲੱਦਾਖ ਘੁੰਮਣ ਜਾਣਾ ਚਾਹੁੰਦਾ ਹਾਂ ਇਸ ਸਬੰਧੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਉਸ ਗਰਮੀ ਦੀਆਂ ਛੁੱਟੀਆਂ ਸਬੰਧੀ ਸਮਰ ਵਕੇਸ਼ਨ ਸਬੰਧੀ ਕੋਈ ਤੁ ਤੁਹਾਡੀ ਏਜੰਸੀ ਵੱਲੋਂ ਕੋਈ ਸਪੈਸ਼ਲ ਔਫਰ ਚੱਲ ਰਿਹਾ ਹੈ ਜਾਂ ਫਿਰ ਤੁਹਾਡੀ ਏਜੰਸੀ ਵੱਲੋਂ ਆਪਣੇ ਰੈਗੂਲਰ ਗ੍ਰਾਹਕ ਵਾਸਤੇ ਕੁਛ ਸਪੈਸ਼ਲ ਔਫਰ ਚੱਲ ਰਿਹਾ ਹੈ ਜਿਸ ਦਾ ਮੈਂ ਲਾਭ ਲੈ ਸਕਦਾ ਹਾਂ ਇਸ ਸਬੰਧੀ ਮੈਨੂੰ ਜਾਣਕਾਰੀ ਦਿੱਤੀ ਜਾਵੇ ਕੀ ਕੁੱਲੂ ਮਨਾਲੀ ਅਤੇ ਲੇਹ ਲੱਦਾਖ ਦਾ ਕੈਬ ਬੁੱਕ ਕਰਵਾਉਣ ਅਤੇ ਕਿੰਨਾ ਕਿਰਾਇਆ ਹੋਵੇਗਾ ਇਸ ਵਿੱਚ ਟੋਲ ਡਰਾਈਵਰ ਅਤੇ ਪਾਰਕਿੰਗ ਦੀ ਪਰਚੀ ਇੰਨਕਲੂਡ ਹੋਵੇਗੀ ਜਾਂ ਉਹ ਸਾਡੀ ਆਪਣੀ ਹੋਵੇਗੀ ਡਰਾਈਵਰ ਦਾ ਖਾਣ ਪੀਣ ਦਾ ਰੋਟੀ ਦਾ ਖਰਚਾ ਏਜੰਸੀ ਦਾ ਇੰਨਕਲੂਡ ਹੋਵੇਗਾ ਜਾਂ ਕਿ ਉਸਦਾ ਅਲੱਗ ਖਰਚਾ ਹੋਵੇਗਾ ਇਸ ਸਬੰਧੀ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਇਸ ਦਾ ਕੁੱਲ ਕਿੰਨਾ ਖਰਚਾ ਹੋਵੇਗਾ ਅਤੇ ਕਿੰਨੇ ਦਿਨ ਦੇ ਤਿੰਨ ਦਿਨਾਂ ਦੀ ਪਲੈਨਿੰਗ ਦੇ ਕਿੰਨਾ ਕੁ ਖਰਚਾ ਹੋਵੇਗਾ